ਹੈਲੋ ਮੈਂ ਹਰਸ਼ਪ੍ਰੀਤ ਸਿੰਘ ਬੋਲਦਾ ਹਾਂ ਮੈਂ ਕੀ ਤੁਸੀਂ ਪ੍ਰੀਤ ਢਾਬੇ ਤੋਂ ਬੋਲਦੇ ਹਨ ਮੈਂ ਖਾਣਾ ਮੰਗਾਉਣਾ ਹੈ ਜੀ ਜੀ ਖਾਣੇ ਵਿੱਚ ਪਨੀਰ ਦੀ ਸਬਜ਼ੀ ਦਾਲ ਮੱਖਣੀ ਰੋਟੀ ਰੋਟੀ ਪੈਕ ਕਰਨੀ ਹੈ ਅਤੇ ਜੇ ਤੁਹਾਡੇ ਕੋਲ ਮਿੱਠੇ ਵਿੱਚ ਕੇਕ ਆਈਸਕ੍ਰੀਮ ਵਗੈਰਾ ਹੈ ਤਾਂ ਤੁਸੀਂ ਕੇਕ ਹੈਗਾ ਜੇਕਰ ਫਿਰ ਤੁਸੀਂ ਕੇਕ ਪੈਕ ਕਰ ਦਿਓ ਅਗਰ ਜੇ ਕੇਕ ਨਹੀਂ ਹੈ ਤਾਂ ਆਈਸਕ੍ਰੀਮ ਵੀ ਵਨੀਲਾ ਚੋਕਲੇਟ ਫਲੇਵਰ ਕੋਈ ਵੀ ਪੈਕ ਕਰ ਦਿਓ ਜੇਕਰ ਤੁਹਾਡੇ ਕੋਲ ਮੋਤੀਚੂਰ ਦੇ ਫਰੈਸ਼ ਲੱਡੂ ਬਣੇ ਹੋਏ ਹਨ ਉਹ ਵੀ ਕਿੱਲੋ ਪੈਕ ਕਰ ਦਿਓ ਕਨ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦੇਣੇ ਹਨ ਅਤੇ ਜੇਕਰ ਤੁਹਾਨੂੰ ਹੋਰ ਵੀ ਕੁਛ ਮਿੱਠੇ ਵਿੱਚ ਹੈਗਾ ਹੈ ਤਾਂ ਉਹ ਪੈਕ ਕਰ ਦਿਓ ਅਤੇ ਮੈਂ ਆਪਣੀ ਪੇਮੈਂਟ ਔਨਲਾਈਨ ਅਤੇ ਕੈਸ਼ ਦੋਨੇ ਕਰ ਸਕਦਾ ਹਨ ਅਤੇ ਚਲੋ ਚਲ ਠੀਕ ਹੈ ਮੈਂ ਤੁਹਾਡੀ ਉਡੀਕ ਕਰੂੰਗਾ